ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤਸਰ ਦੇ ਵਿੱਚ ਵਾਤਾਵਰਨ ਦੀ ਸੰਭਾਲ ਦੇ ਲਈ ਬਹੁਤ ਹੀ ਵਧੀਆ ਵਧੀਆ ਪਹਿਲ ਕਦਮੀਆਂ ਹਨ ਜਿਹਨਾਂ ਨੂੰ ਮਹੱਤਵਪੂਰਨ ਦੇਣੀ ਚਾਹੀਦੀ ਹੈ ਜਿਵੇਂ ਕਿ ਵਾਤਾਵਰਨ ਵਾਤਾਵਰਨ ਨੂੰ ਸਾਨੂੰ ਸਾਫ ਰੱਖਣਾ ਚਾਹੀਦਾ ਹੈ ਵਾ ਵਾਤਾਵਰਨ ਦੇ ਨਾਲ ਇਨਸਾਨ ਬਹੁਤ ਹੀ ਚੰਗੀ ਤਰ੍ਹਾਂ ਜੁੜਿਆ ਹੁੰਦਾ ਹੈ ਵਾਤਾਵਰਨ ਜੇ ਸਹੀ ਹੋਏਗਾ ਤਾਂ ਇਨਸਾਨ ਦਾ ਸਿਹਤ ਵੀ ਸਹੀ ਰਹੇਗੀ ਅਤੇ ਜੇ ਵਾਤਾਵਰਨ ਹੀ ਖ਼ਰਾਬ ਹੋਏਗਾ ਵਾਤਾਵਰਨ ਦੇ ਵਿੱਚ ਹੀ ਪ੍ਰਦੂਸ਼ਣ ਹੋਏਗਾ ਤਾਂ ਇਨਸਾਨ ਦਾ ਸਰੀਰ ਵੀ ਗਲਤ ਹੋਏਗੀ ਅਤੇ ਉਹਨੂੰ ਵੀ ਬਹੁਤ ਸਾਰੇ ਨੁਕਸਾਨ ਹੋਣਗੇ ਵਾਤਾਵਰਨ ਨੂੰ ਸਾਫ ਸੁਥਰਾ ਅਸੀਂ ਕਿਵੇਂ ਰੱਖ ਸਕਦੇ ਹਾਂ ਅਸੀਂ ਹਰ ਜੋ ਵੀ ਅਸੀਂ ਖਾਂਦੇ ਹਾਂ ਅਸੀਂ ਇੱਕ ਜਗ੍ਹਾ 'ਤੇ ਰੱਖ ਕੇ ਉਹਨੂੰ ਡਸਟਬੀਨ ਦੇ ਵਿੱਚ ਪਾ ਕੇ ਫਿਰ ਸੰਭਾਲ ਸਕਦੇ ਹਾਂ ਪਰ ਕਈ ਲੋਕ ਐਵੇਂ ਨਹੀਂ ਕਰਦੇ ਕਈ ਲੋਕ ਬਹੁਤ ਹੀ ਗਲਤ ਇਸਤੇਮਾਲ ਕਰਦੇ ਹਨ ਉਹ ਵਾਤਾਵਰਨ ਦੇ ਬਾਰੇ ਬਿਲਕੁਲ ਵੀ ਨਹੀਂ ਸੋਚਦੇ ਅਤੇ ਜੋ ਵੀ ਕੁਛ ਖਾਂਦੇ ਨੇ ਉਹਨੂੰ ਆਪਣੇ ਆਲੇ ਦੁਆਲੇ ਹੀ ਸੁੱਟ ਦਿੰਦੇ ਹਨ ਜਿਸ ਦੇ ਕਾਰਨ ਵਾਤਾਵਰਨ ਬਹੁਤ ਹੀ ਜ਼ਿਆਦਾ ਪ੍ਰਦੂਸ਼ਿਤ ਹੋ ਜਾਂਦਾ ਹੈ ਅਤੇ ਕੁਛ ਲੋਕ ਗਮਲਿਆਂ ਆਦਿ ਪੇੜਾਂ ਨੂੰ ਵੀ ਕੱਟਦੇ ਹਨ ਜਿਹਦੇ ਕਰਕੇ ਵਾਤਾਵਰਨ ਵਿੱਚ ਬਹੁਤ ਖ਼ਰਾਬੀ ਆਉਂਦੀ ਹੈ ਜੇਕਰ ਪੇੜ ਹੀ ਨਾ ਹੋਣਗੇ ਤਾਂ ਆਦਮੀ ਸਾਹ ਕਿੱਥੋਂ ਲੈ ਸਕੇਗਾ ਇਸ ਲਈ ਵਾਤਾਵਰਨ ਬਹੁਤ ਹੀ ਜ਼ਰੂਰੀ ਅਹਿਮੀਅਤ ਨਿਭਾਉਂਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਜੋ ਵੀ ਖਾਂਦੇ ਪੀਂਦੇ ਹਾਂ ਅਸੀਂ ਸਾਰਾ ਵੇਸਟ ਪ੍ਰੋਡਕਟ ਉਹ ਅਸੀਂ ਡਸਟਬੀਨ ਦੇ ਵਿੱਚ ਪਾ ਕੇ ਅਤੇ ਉਸ ਡਿਸਟਬਿਨ ਦੇ ਹਿਸਾਬ ਦੇ ਨਾਲ ਪਾ ਕੇ ਕਿ ਦੁਬਾਰਾ ਉਹ ਰੀਸਾਈਕਲ ਹੋ ਸਕੇ ਤਾਂ ਕਿ ਉਹ ਦੁਬਾਰਾ ਸਾਡੇ ਕੰਮ ਵਿੱਚ ਆ ਸਕੇ ਇਸ ਕਰਕੇ ਅਸੀਂ ਇਸ ਵਾਤਾਵਰਨ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਧੰਨਵਾਦ ਜੀ